ਠੀਕ ਹੈ ਜੀ ਇੱਥੇ ਜੀ ਅੜੀਸਰ ਬਹੁਤ ਵਧੀਆ ਗੁਰਦੁਆਰਾ ਅਤੇ ਨਾਲੇ ਇੱਥੇ ਓਟਲੇਟ ਬਹੁਤ ਵਧੀਆ ਉੱਥੇ ਫੈਂਸੀ ਕੱਪੜੇ ਮਿਲਦੇ ਨੇ ਅਤੇ ਨਾਲੇ ਇੱਥੇ ਕੀ ਕਹਿੰਦੇ ਹੁੰਦੇ ਨੇ ਪਾਰਕਿੰਗ ਟੂ ਪਾਰਕ ਅਤੇ ਉਹਦੇ ਵਿੱਚ ਬਹੁਤ ਚਿੜੀਆ ਘਰ ਹੈ ਜੀ ਚਿੜੀਆ ਘਰ ਵਿੱਚ ਬਹੁਤ ਵਧੀਆ ਜਾਨਵਰ ਨੇ ਅਤੇ ਵੇਖਣ ਯੋਗ ਹੈ ਜੀ ਜਾਨਵਰ ਉਹਦੇ ਵਿੱਚ ਨਾਲੇ ਇੱਥੇ ਆਪਣਾ ਆਧਾਰ ਹੈ ਜੀ ਆਧਾਰ ਦੇ ਵਿੱਚ ਵੀ ਬਹੁਤ ਵਧੀਆ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਮਿਲਦੀਆਂ ਦੇਖਣ ਵਾਲੀਆਂ ਚੀਜ਼ਾਂ ਵੀ ਬਹੁਤ ਮਿਲਦੀਆਂ ਨੇ ਹਾਂ ਤੁਸੀਂ ਕਦੋਂ ਆਉਂਗੇ ਤਾਂ ਸਾਨੂੰ ਦੱਸੋ ਠੀਕ ਹੈ ਜੀ ਜ਼ਰੂਰ ਦਿਖਾਵਾਂਗੇ ਤੁਹਾਨੂੰ ਬੱਚਿਆਂ ਲਈ ਦੇਖਣ ਵਾਲੇ ਵੀ ਬਹੁਤ ਵਧੀਆ ਝੂਲੇ ਵੀ ਹੈ ਚਿੰਟੂ ਪਾਰਕ ਵਿੱਚ ਅਤੇ ਦੇਖਣ ਵਾਲੀਆਂ ਚੀਜ਼ਾਂ ਨੇ ਜੀ ਹਾਂਜੀ ਹਾਂ ਚਿੰਟੂ ਪਾਰਕ ਬਹੁਤ ਵਧੀਆ ਹੈਗੀ ਪਾਰਕ ਵਿੱਚ ਦੇਖਣ ਵਾਲੀਆਂ ਚੀਜ਼ਾਂ ਨੇਗੀਆਂ ਬੱਚਿਆਂ ਦੇ ਝੂਲੇ ਵੀ ਹੈ ਹੋਰ ਵੀ ਹੈ ਸਮਾਨ ਬਹੁਤ ਵਧੀਆ ਨੇ ਜੇ ਤੁਸੀਂ ਆਉਂਗੇ ਤਾਂ ਤੁਹਾਨੂੰ ਅਸੀਂ ਸਾਰੇ ਘੁਮਾਵਾਂਗੇ ਹਾਂਜੀ ਤੁਸੀਂ ਸਾਨੂੰ ਦੱਸਣਾ ਜਦੋਂ ਆਉਂਗੇ ਹਾਂਜੀ ਹਾਂ ਇੱਥੇ ਕੱਚਾ ਗੁਰੂਸਰ ਵੀ ਹੈਗਾ ਜੀ ਇੱਥੇ ਬਬ ਦਸਵੇਂ ਪਾਤਸ਼ਾਹ ਨੇ ਤੇਗ ਬਹਾਦਰ ਜੀ ਨੇ ਘੋੜਾ ਅੜੀ ਪੈ ਗਿਆ ਸੀਗਾ ਜੀ ਇੱਥੇ ਅਤੇ ਉਵੇਂ ਜੇ ਕੋਈ ਘੋੜਾ ਬੰਨਣ ਨੂੰ ਆਪਣਾ ਜੰਡ ਵੀ ਉਵੇਂ ਜੇ ਕੋਈ ਹੈਗਾ ਤੁਸੀਂ ਆਉਂਗੇ ਅਸੀਂ ਤੁਹਾਨੂੰ ਸਾਰਾ ਦਰਸ਼ਨ ਕਰਾਵਾਂਗੇ ਬਹੁਤ ਵਧੀਆ ਇੱਥੇ ਗੁਰਦੁਆਰੇ ਬਹੁਤ ਗੁਰਦੁਆਰੇ ਨੇ ਕੱਚਾ ਗੁਰੂਸਰ ਵੀ ਹੈ ਪੱਕਾ ਗੁਰੂਸਰ ਵੀ ਹੈ ਹਾਂ ਆਪਣੇ ਦੇਖਣ ਯੋਗ ਬਹੁਤ ਚੀਜ਼ਾਂ ਨੇ ਇੱਥੇ ਤੁਸੀਂ ਹਾਂਜੀ ਸਰ ਖਾਣ ਪੀਣ ਖਾਣ ਹਾਂਜੀ ਬਹੁਤ ਬਹੁਤ ਵਧੀਆ ਇੱਥੇ ਓਟਲੇਟ ਹੈ ਜੀ ਉਹਦੇ ਵਿੱਚ ਬਹੁਤ ਕੋਫੀ ਵੀ ਵਧੀਆ ਮਿਲਦੀ ਹੈ ਅਤੇ ਹੋਰ ਖਾਣ ਵਾਲੀਆਂ ਚੀਜ਼ਾਂ ਵੀ ਵਧੀਆ ਮਿਲਦੀਆਂ ਜੀ ਅਤੇ ਹਾਂ ਹਾਂਜੀ ਫੈਕਟਰੀਆਂ ਇੱਥੇ ਬਹੁਤ ਹੈ ਜੀ ਤੁਸੀਂ ਸਟੈਂਡਰਡ ਕੰਬੈਨ ਵਾਲੀਆਂ ਫੈਕਟਰੀਆਂ ਉਹ ਵੀ ਦੇਖਣ ਵਾਲੀਆਂ ਨੇ ਬਾਕੀ ਬਹੁਤ ਹੀ ਵਧੀਆ ਜੀ ਇੱਥੇ ਬਰਨਾਲੇ ਜ਼ਿਲ੍ਹੇ ਵਿੱਚ ਬਹੁਤ ਵਧੀਆ ਫੈਕਟਰੀਆਂ ਜੀ ਹਾਂਜੀ ਹਾਂਜੀ ਕੁ ਕੋਈ ਗੱਲ ਨਹੀਂ ਠੀਕ ਹੈ ਜੀ ਹਾਂਜੀ ਤੁਹਾਨੂੰ ਨਾਲ ਲਿਜਾ ਕੇ ਜ਼ਰੂਰ ਦਿਖਾਵਾਂਗੇ ਜੀ ਤੁਸੀਂ ਆਇਓ ਸਾਡਾ ਫੋਨ ਨੰਬਰ ਨੋਟ ਕਰ ਲਿਓ ਅਤੇ ਹਾਂ ਅਸੀਂ ਜ਼ਰੂਰ ਦਿਖਾਵਾਂਗੇ ਜੀ ਤੁਹਾਨੂੰ ਹਾਂਜੀ ਹੋਰ ਵੀ ਇੱਥੇ ਬਹੁਤ